ਮੈਨੂੰ ਦੀਵਾਲੀ ਜਿਵੇਂ ਕੀ ਦੀਵਾਲੀ ਦਾ ਫੇਸਟੀਬਲ ਹੈ ਨਾ ਉਹ ਉੱਥੇ ਗਾਉਣਾ ਬਹੁਤ ਪਸੰਦ ਹੈ ਕਿਉਂਕੀ ਕਿਉਂਕੀ ਆਸ ਪਾਸ ਦੇ ਏਰੀਆ ਔਰ ਆਪਦੀ ਘਰ ਦੀ ਹੁੰਦੀ ਹਨ ਉੱਥੇ ਮੈਂ ਆਰਾਮ ਨਾਲ ਗਾਣਾ ਗਾ ਸਕਦੀ ਹਾਂ ਬਿਨਾਂ ਡਰ ਤੋਂ ਕਿਉਂਕੀ ਮੈਨੂੰ ਉੱਥੇ ਗਾਉਣਾ ਜਿਵੇਂ ਕੀ ਲੋਹੜੀ ਹੋ ਗਹੀ ਉੱਥੇ ਵੀ ਮੈਂ ਗਾਉਣਾ ਪਸੰਦ ਕਰਦੀ ਹਾਂ ਜੀ ਲੋਹੜੀ ਤੇ ਦੀਵਾਲੀ ਤੇ ਹੋਲੀ ਤੇ ਪ੍ਰੋਗਰਾਮ ਕਈ ਪ੍ਰੋਗਰਾਮ ਤੇ ਗਾਉਣਾ ਪਸੰਦ ਕਰਦੀ ਹਾਂ ਵਿਆਹ ਸ਼ਾਦੀਆਂ ਦੇ ਮੌਕੇ ਤੇ ਨਹੀਂ ਪਸੰਦ ਕਰਦੀ ਕਿਉਂਕੀ ਉੱਥੇ ਮੈਂ ਆਪਣੇ ਆਪ ਨੂੰ ਅਨਕੰਫਰਟੇਬਲ ਮਹਿਸੂਸ ਕਰਦੀ ਹਾਂ ਕਿਉਂਕੀ ਲੋਹੜੀ ਤੇ ਅਸੀਂ ਸਾਰੀਆਂ ਫਰੈਂਡਸ ਇਕੱਠੇ ਹੋ ਕੇ ਇੱਕ ਦੂਸਰੇ ਟੀਚਰਾਂ ਦੇ ਨਾਲ ਜਾਉਂਦੇ ਟੀਚਰਾਂ ਕੋਲੋ ਲੋਹੜੀ ਮੰਗਦੇ ਹਾਂ ਤੇ ਬਹੁਤ ਇੰਜੋਏ ਕਰਦੇ ਹਾਂ ਤੇ ਸਾਡੇ ਮਨ ਨੂੰ ਸ਼ਾਂਤੀ ਜੀ ਮਿਲਦੀ ਹੈ ਤੇ ਨਾ ਸਾਨੂੰ ਡਰ ਜਿਹਾ ਲੱਗਦਾ ਹੈ ਡਰ ਵੀ ਨਹੀਂ ਲੱਗਦਾ ਕਿਉਂਕੀ ਅਸੀਂ ਬੇਝੀਜਕ ਹੋ ਕੇ ਲੋਹੜੀ ਅਤੇ ਦੀਵਾਲੀ ਦੇ ਪ੍ਰੋਗਰਾਮ ਤੇ ਅਸੀਂ ਗਾਅ ਲੇਨੇ ਹਾਂ ਕਿਉਂਕੀ ਲੋਹੜੀ ਇੱਕ ਅਜਿਹਾ ਤਿਉਹਾਰ ਹੈ ਜਿੱਥੇ ਵਿੱਚ ਅਸੀਂ ਗੋ ਵੀ ਬਹੁਤ ਸਾਰੇ ਜਨੇ ਇਕੱਠੇ ਹੋ ਕੇ ਗਾ ਲੇਨੇ ਹਾਂ ਜਿਵੇਂ ਕੀ ਜਿਵੇਂ ਕੀ ਸੌਂਗ ਹੈ ਨਾ ਚਿੜੀਆਂ ਦਾ ਚੰਬਾ ਵੇ ਉਹ ਇੱਕ ਦਿਨ ਉੱਡ ਜਾਨਾ ਐਵੇਂ ਬੀ ਗਾ ਲੇਨੇ ਆਂ ਤੇ ਅਸੀਂ ਬਹੁਤ ਕੰਫਰਟੇਬਲ ਮਹਿਸੂਸ ਕਰਦੇ ਆਂ ਸਾਨੂੰ ਕੋਈ ਉਹ ਡਰ ਜਾ ਨਹੀਂ ਲੱਗਦਾ